ਸੈਲਫ ਹੈਲਪ ਦਾ ਅਰਥ ਹੈ ਆਪਣੀ ਮਦਦ ਆਪ ਕਰਨਾ ਜਿੱਦਾਂ ਸਾਨੂੰ ਕਈ ਫੀਲਡ ਵਿੱਚ ਆਪਣੀ ਮਦਦ ਆਪ ਕਰਨੀ ਪੈਂਦੀ ਹੈ ਜਿੱਦਾਂ ਸਾਨੂੰ ਆਪਣੀ ਰੋਟੀ ਆਪ ਬਣਾਉਣੀ ਪੈਂਦੀ ਹੈ ਘਰ ਵਿੱਚ ਅਗਰ ਜੇਕਰ ਕੋਈ ਨਹੀਂ ਹੋਇਆ ਤਾਂ ਸਾਨੂੰ ਝਾੜੂ ਪੋਚਾ ਵੀ ਆਪ ਮਾਰਨਾ ਪੈਂਦਾ ਹੈ ਅਤੇ ਸੈਲਫ ਹੈਲਪ ਸਾਨੂੰ ਆਪਣੇ ਉੱਪਰ ਆਤਮ ਨਿਰਭਰ ਹੋਣਾ ਸਿਖਾਉਂਦਾ ਹੈ ਅਤੇ ਇਹ ਬਹੁਤ ਅੱਛੀ ਗਰੁੱਪ ਹੈ ਸੈਲਫ ਹੈਲਪ ਗਰੁੱਪ ਇੱਕ ਇਹੋ ਜਿਹਾ ਗਰੁੱਪ ਹੈ ਜਿਸ ਕਰਕੇ ਅਸੀਂ ਆਤਮ ਨਿਰਭਰ ਹੋ ਸਕਦੇ ਹਾਂ ਅਤੇ ਔਰਤਾਂ ਲਈ ਰੁਜ਼ਗਾਰ ਦੇ ਕਈ ਚੰਗੇ ਮੌਕੇ ਹਨ ਜਿਹੜੀ ਔਰਤਾਂ ਪੜ੍ਹੀ ਲਿਖੀ ਹਨ ਜਿੱਦਾਂ ਬਾਰਵੀਂ ਪਾਸ ਬੀ ਕੋਮ ਹੋਰ ਵੀ ਕਈ ਮੌਕੇ ਹੈ ਅਤੇ ਉਸ ਨਾਲ਼ ਉਹ ਸਕੂਲ ਵਿੱਚ ਪੜ੍ਹਾ ਸਕਦੀ ਹੈ ਅਤੇ ਜਿਹੜੀ ਔਰਤਾਂ ਪੜ੍ਹੀ ਲਿਖੀ ਨਹੀਂ ਵੀ ਹੈ ਉਹ ਵੀ ਸਿਲਾਈਆਂ ਬੁਣਾਈਆਂ ਕਢਾਈਆਂ ਕਰ ਕਰ ਕਰਕੇ ਆਪਣਾ ਰੁਜ਼ਗਾਰ ਚਲਾ ਸਕਦੀ ਹਨ ਅਤੇ ਜਿਹੜੀ ਔਰਤਾਂ ਜ਼ਿਆਦਾ ਹੀ ਪੜ੍ਹੀ ਲਿਖੀ ਹਨ ਉਹ ਤਾਂ ਇੰਸਟੀਟਿਊਟ ਵਗੈਰਾ ਵਿੱਚ ਵੀ ਪੜ੍ਹਾ ਸਕਦੀ ਹੈ